ਸਾਨੂੰ ਕੁਦਰਤੀ ਵਾਤਾਵਰਨ ਸੰਬੰਧੀ ਬਹੁਤ ਘਟਨਾ ਹੋਈਆਂ ਹਨ ਅਤੇ ਸਾਡੇ ਜੀਵਨ 'ਚ ਬਹੁਤ ਨੁਕਸਾਨ ਆਇਆ ਹੈ ਇ ਇਹਨਾਂ ਦੇ ਕਾਰਨ ਜਿੱਦਾਂ ਕਿ ਉੱਨੀ ਸੌ ਅਠਾਸੀ ਵਿੱਚ ਹੜ੍ਹ ਆਏ ਹਨ ਅਤੇ ਉਹਦੇ ਕਰਕੇ ਕਾਫੀ ਭਾਰੀ ਵਰਖਾ ਹੋਣ ਕਾਰਨ ਸਾਡੇ ਸਾਡੇ 'ਤੇ ਬਹੁਤ ਭਾਰੀ ਨੁਕਸਾਨ ਹੋਏ ਹਨ ਬਹੁਤ ਤਬਾਹੀ ਹੋਈ ਆ ਹੋਰ ਵੀ ਕਾਫੀ ਨੁਕਸਾਨ ਹੋਏ ਹਨ ਅਤੇ ਭਾਰੀ ਤਬਾਹੀ ਹੋਈ ਹੈ ਮੀਂਹ ਦੇ ਕਾਰਨ ਅਤੇ ਕਾਫੀ ਘਰਾਂ ਦੇ ਘਰ ਹੜ੍ਹ ਗਏ ਹਨ ਅਤੇ ਕਾ ਕਈਆਂ ਦੇ ਨਿਆਣੇ ਨਿੱਕੇ ਵੀ ਰੁੜ੍ਹ ਗਏ ਹਨ ਉਹਨਾਂ ਕਰਕੇ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਖੇਤਰ ਦੇ ਵਿੱਚ ਹੋਰ ਵੀ ਕਾਫੀ ਆਵਾਜਾਈ ਨੁਕਸਾਨ ਹੋਏ ਹਨ